ਮੈਨੂੰ ਬਾਗਬਾਨੀ ਦਾ ਸ਼ੌਂਕ ਸਾਇੰਸ ਵੱਲ ਦੇਖ ਕੇ ਪੈਦਾ ਹੋਇਆ ਹੈ ਕਿਉਂਕਿ ਬਾਗ ਵਿੱਚ ਲਗਾਏ ਹੋਏ ਪੌਦੇ ਮਨੁੱਖਤਾ ਲਈ ਬਹੁਤ ਜ਼ਰੂਰੀ ਹਨ ਇਹ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ ਅਤੇ ਆਪਣੇ ਵਾਤਾਵਰਨ ਨੂੰ ਸਾਫ਼ ਰੱਖਦੇ ਹਨ ਇਹ ਇਕੱਲੇ ਵਾਤਾਵਰਨ ਨੂੰ ਸਾਫ਼ ਕਰਨ ਵਿੱਚ ਮਦਦ ਨਹੀਂ ਕਰਦੇ ਇਹ ਮਨੁੱਖ ਨੂੰ ਵਧੀਆ ਔਕਸੀਜਨ ਪ੍ਰੋਵਾਈਡ ਕਰਦੇ ਹਨ ਅਤੇ ਜਿਹੜੇ ਦੇਸ਼ ਦਾ ਵਾਤਾਵਰਣ ਵਧੀਆ ਹੁੰਦਾ ਹੈ ਅਤੇ ਉੱਥੇ ਦੇ ਮਨੁੱਖ ਵੀ ਵਧੀਆ ਹੁੰਦੇ ਹਨ ਇਸ ਦੌਰਾਨ ਮੈਨੂੰ ਪ੍ਰੇਰਨਾ ਮਿਲੀ ਹੈ ਕਿ ਮੈਨੂੰ ਵੀ ਆਪਣੇ ਬਾਗ ਲਗਾਉਣੇ ਚਾਹੀਦੇ ਹਨ ਜਿਹਦੇ ਨਾਲ ਸਾਡੇ ਪਿੰਡ ਦਾ ਮਾਹੌਲ ਵਧੀਆ ਹੋਵੇ ਅਤੇ ਸਾਰੇ ਲੋਕ ਹੱਸਦੇ ਵਸਦੇ ਰਹਿਣ ਕਿਸੇ ਨੂੰ ਵੀ ਕੋਈ ਬਿਮਾਰੀ ਨਾ ਲੱਗੇ ਏ ਜ਼ਿਆਦਾਤਰ ਬਾਗਾਂ ਨਾਲ ਕੈਂਸਰ ਦੀਆਂ ਬਿਮਾਰੀਆਂ ਵੀ ਦੂਰ ਹੋ ਜਾਂਦੀਆਂ ਹਨ ਇੱਥੇ ਬਹੁਤ ਸਾਰੇ ਬਾਗ ਹਨ ਜਿਹੜੇ ਜਿਹੜੇ ਕੈਂਸਰ ਦੇ ਇਲਾਜ ਵਿੱਚ ਮਦਦ ਕਰਦੇ ਹਨ ਬਹੁਤ ਸਾਰੇ ਮਨੁੱਖ ਵਿਹਲੇ ਟੈਮ 'ਤੇ ਬਾਗਾਂ ਵਿੱਚ ਆਉਂਦੇ ਹਨ ਅਤੇ ਬਹੁਤ ਖੁਸ਼ੀ ਪ੍ਰਾਪਤ ਕਰਦੇ ਹਨ